ਹਾਂਜੀ ਮੈਂ ਇੱਕ ਵਾਰ ਕੇਰਲਾ ਦੇ ਟੂਰ 'ਤੇ ਗਿਆ ਸੀ ਸਟੱਡੀ ਟੂਰ ਸੀਗਾ ਸਾਡਾ ਉਹ ਉਸ ਵੇਲੇ ਗਿਆ ਸੀ ਮੈਂ ਸੰਪਰਕ ਬਣਾਉਣ ਵਿੱਚ ਅਤੇ ਉਨ੍ਹਾਂ ਦੇ ਸੱਭਿਆਚਾਰ ਦੇ ਵਿੱਚ ਬੜਾ ਉਹ ਡਿਫਰੈਂਟ ਹੈ ਆਪਣੇ ਨਾਲੋਂ ਇੱਧਰ ਪੰਜਾਬ ਦੇ ਨਾਲੋਂ ਬਹੁਤ ਜ਼ਿਆਦਾ ਡਿਫਰੈਂਟ ਹੈ ਉਨ੍ਹਾਂ ਦਾ ਸੱਭਿਆਚਾਰ ਵੀ ਵੱਖਰਾ ਸਾਡੇ ਨਾਲੋਂ ਅਤੇ ਉਨ੍ਹਾਂ ਦੀ ਭਾਸ਼ਾ ਵੀ ਵੱਖਰੀ ਫਿਰ ਅਸੀਂ ਉੱਥੋਂ ਦਾ ਇੱਕ ਵਸਨੀਕ ਸੀ ਉਸਨੂੰ ਹਿੰਦੀ ਵੀ ਆਉਂਦੀ ਸੀ ਅਤੇ ਉਹ ਉੱਧਰਲੀ ਭਾਸ਼ਾ ਵੀ ਸਮਝਦਾ ਸੀ ਫਿਰ ਅਸੀਂ ਉਸ ਨਾਲ ਗੱਲ ਬਾਤ ਕੀਤੀ ਬਸ ਉਸ ਨੇ ਹੀ ਸਾਨੂੰ ਸਾਰਾ ਸਮਝਾਇਆ ਉਸ ਨੂੰ ਅਸੀਂ ਇੱਕ ਇੱਕ ਟੂਰਿਸਟ ਗਾਈਡ ਦੇ ਤੌਰ 'ਤੇ ਵਰਤਿਆ ਅਤੇ ਉਸਨੇ ਸਾਨੂੰ ਸਹਾਇਤਾ ਕੀਤੀ ਉਹ ਐਕਸਪੀਰੀਐਂਸ ਵੀ ਮੇਰਾ ਬਹੁਤ ਵਧੀਆ ਰਿਹਾ